ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲਦਾ ਹਾਂਜੀ ਬੋਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗਾ ਤੁਸੀਂ ਆਓ ਸਾਡੇ ਰਜਿੰਦਰਾ ਹੋਸਪੀਟਲ 'ਚ ਆਓ ਅਤੇ ਇਹਦਾ ਇਲਾਜ ਬਹੁਤ ਵਧੀਆ ਹੋਏਗਾ ਹਾਂਜੀ ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਜਿਹੜਾ ਇਹ ਕਾਰਡ ਚੱਲਿਆ ਹੋਇਆ ਹੈਗਾ ਆਪਣਾ ਤੁਸੀਂ ਹੈਲਥ ਕਾਟ ਬਣਵਾਇਆ ਹੋਣਾ ਇਹਦੇ 'ਤੇ ਹਾਂਜੀ ਇਹਦੇ 'ਤੇ ਦਵਾਈ ਵੀ ਮੁਫਤ ਹੈਗੀ ਬਿਲਕੁਲ ਫਰੀ ਹੈਗੀ ਹਾਂਜੀ ਤੁਸੀਂ ਆ ਜਾਣਾ ਇੱਥੇ ਬੈੱਡ ਵਗੈਰਾ ਵੀ ਸਾਰਾ ਇੰਤਜਾਮ ਹੈਗਾ ਬਹੁਤ ਵਧੀਆ ਹੈਗਾ ਸਫ਼ਾਈ ਦਾ ਵੀ ਪ੍ਰਬੰਧ ਹੈ ਬਹੁਤ ਜ਼ਿਆਦਾ ਹਾਂਜੀ ਕੋਈ ਨਹੀਂ ਆ ਜਾਣਾ ਇੱਥੇ ਟੈਸਟ ਵੀ ਫਰੀ ਨੇਂਗੇ ਹੁਣ ਤਾਂ ਸਰਕਾਰ ਨੇ ਕਰਤੇ ਨਾ ਫਰੀ ਟੈਸਟ ਵਗੈਰਾ ਸਾਰਾ ਕੁਛ ਦਵਾਈਆਂ ਵੀ ਅੰਦਰੋਂ ਹੀ ਮਿਲਣਗੀਆਂ ਸਭ ਕੁਛ ਨਹੀਂ ਨਹੀਂ ਕੋਈ ਦਿੱਕਤ ਨਹੀਂ ਸਗੋਂ ਦੀ ਵਧੀਆ ਆ ਤੁਸੀਂ ਸੈਰ ਵਗੈਰਾ ਕਰ ਰਹੇ ਹੋ ਵਧੀਆ ਆਪਣੇ ਸਰੀਰ ਨੂੰ ਫਿੱਟ ਰੱਖੋ ਟੈਂਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਕੋਈ ਨਹੀਂ ਤੁਸੀਂ ਸਾਡੇ ਕੋਲ ਆਇਓ ਜਿਹੜੀਆਂ ਦਵਾਈਆਂ ਨੇ ਉਹ ਵੀ ਲੈ ਕੇ ਆਉਣਾ ਆਪਣੇ ਟੈਸਟ ਵਗੈਰਾ ਵੀ ਲੈ ਆਉਣਾ ਅਤੇ ਅਸੀਂ ਦੇਖ ਕੇ ਫਿਰ ਤੁਹਾਡਾ ਚੈੱਕਅੱਪ ਕਰਦੇ ਹਾਂ ਆਪਾਂ ਤੁਹਾਨੂੰ ਐਡਮਿੰਟ ਕਰਕੇ ਠੀਕ ਹੈ ਹਾਂਜੀ ਤੁਸੀਂ ਜਦ ਮਰਜੀ ਆ ਜਾਣਾ ਮੈਂ ਉਂ ਬਾਕੀ ਮੈਂ ਤੁਹਾਨੂੰ ਕੋਲ ਕਰ ਦਾਂਗੀ ਠੀਕ ਹੈ ਤੁਸੀਂ ਜਦੋਂ ਮਰਜੀ ਆਪਣਾ ਆ ਸਕਦੇ ਹੋ ਨਹੀਂ ਕੋਈ ਪਰਹੇਜ ਨਹੀਂ ਹੈਗਾ ਤੁਸੀਂ ਆ ਜਾਣਾ ਆਪਣੇ ਟੈਸਟ ਵਗੈਰਾ ਸਾਰੇ ਨਾਲ ਲੈ ਕੇ ਆਉਣਾ ਜਿਹੜੇ ਕਰਵਾਏ ਨੇ ਠੀਕ ਹੈ ਠੀਕ ਹੈ ਥੈਂਕ ਯੂ